ਪੰਜਾਬ ਵਿੱਚ ਬਹੁਤ ਪ੍ਰਮੁੱਖ ਕਲਾ ਸਕੂਲ ਜਾਂ ਸੰਸਥਾਵਾਂ ਹਨ ਜੋ ਵੱਖ ਵੱਖ ਕਲਾ ਰੂਪਾਂ ਵਿੱਚ ਸਿਖਲਾਈ ਜਾਂ ਸਿੱਖਿਆ ਪ੍ਰਦਾਨ ਕਰਦੇ ਜਿਵੇਂ ਕਿ ਪੰਜਾਬੀ ਕਲਾ ਭਵਨ ਇਹਦੇ ਵਿੱਚ ਕਲਾ ਸਿਖਾਈ ਜਾਂਦੀ ਹੈ ਹੱਥਾਂ ਦੀ ਕਲਾ ਹੋ ਗਈ ਜੋ ਕਿ ਬਹੁਤ ਮਸ਼ਹੂਰ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਕਿ ਭੰਗੜੇ ਸਿਖਾਉਂਦੇ ਹਨ ਅਤੇ ਭੰਗੜੇ ਵਿੱਚ ਮਸ਼ਹੂਰ ਹਨ ਗੌਰਮਿੰਟ ਕੋਲੇਜਿਸ ਔਫ ਆਰਟ ਚੰਡੀਗੜ੍ਹ ਜੋ ਕਿ ਆਰਟ ਐਂਡ ਕਰਾਫ਼ਟ ਸਿਖਾਉਂਦੇ ਹਨ ਪੇਂਟ ਪੇਂਟਿੰਗਸ ਬਹੁਤ ਜ਼ਿਆਦਾ ਇਨ੍ਹਾਂ ਦੀਆਂ ਵਾਇਰਲ ਹੁੰਦੀਆਂ ਨੇ ਅਤੇ ਇਹ ਬਹੁਤ ਵਧੀਆ ਸਿਖਾਉਂਦੇ ਹਨ ਐਜੂਕੇਟ ਕਰਦੇ ਹੈ ਸਾਰਾ ਆਰਟ ਐਂਡ ਕਰਾਫ਼ਟ ਨੂੰ ਔਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੋ ਗਈ ਜੋ ਕਿ ਟੈਕਨੀਕਲ ਹੁੰਦੀ ਹੈ ਟੈਕਨੀਕਲ ਚੀਜ਼ਾਂ ਲਈ ਹੁੰਦੀ ਹੈ ਟੈਕਨੀਕਲ ਚੀਜ਼ਾਂ ਸਿਖਾਉਂਦੇ ਹਨ ਸਾਨੂੰ ਟੈਕਨੋਲੋਜੀ ਦੱਸਦੇ ਹਨ ਕੀ ਕੀ ਅੱਜ ਕੱਲ੍ਹ ਚੱਲਦਾ ਪਿਆ ਵਾ ਸਭ ਕੁਛ